ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਪਵਨਪ੍ਰੀਤ ਸਿੰਘ ਬੋਲ ਰਿਹਾ ਵਾਂ ਤੁਸੀਂ ਅਮਨ ਜੀ ਬੋਲ ਰਹੇ ਹੋ ਸਰ ਜੀ ਮੈਂ ਨਾ ਹਾਂ ਜੀ ਮੈਂ ਨਾ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਦੀ ਨਾ ਯੋਜਨਾ ਬਣਾ ਰਿਹਾ ਸੀ ਕਿ ਚਲੀਏ ਕਰਤਾਰਪੁਰ ਕਾਫੀ ਦਿਨ ਹੋ ਗਏ ਆ ਮੈਂ ਬਾਹਰ ਸੀਗਾ ਤੇ ਹੁਣੇ ਹੁਣੇ ਪੰਜਾਬ ਆਇਆ ਸੀ ਮੈਂ ਕਰਤਾਰਪੁਰ ਜਾਣ ਦੀ ਸੋਚ ਰਿਹਾ ਸੀ ਕਿ ਚਲੋ ਗੇੜਾ ਲਾ ਹੀ ਆਨੇ ਤੁਸੀਂ ਮੈਨੂੰ ਕੁਝ ਜਾਣਕਾਰੀ ਦੇ ਸਕਦੇ ਹੋ ਅੱਛਾ ਜੀ ਉਹ ਤਾਂ ਵਧੀਆ ਬਹੁਤ ਵਧੀਆ ਜੀ ਕੀ ਮੈਨੂੰ ਪਹਿਲਾਂ ਤਾਂ ਰਜਿਸਟਰੇਸ਼ਨ ਕਰਾਣੀ ਪਊਗੀ ਮਤਲਬ ਮੈਨੂੰ ਪਹਿਲਾਂ ਤਾਂ ਥੋੜੀ ਤਿਆਰੀ ਕਰਨੀ ਪਊਗੀ ਅੱਛਾ ਜੀ ਇਹ ਤੇ ਗੱਲ ਵਧੀਆ ਮੈਂ ਇੱਕ ਹੋਰ ਗੱਲ ਪੁੱਛਣੀ ਸੀ ਮੈਨੂੰ ਜਿਹੜਾ ਪਾਸਪੋਰਟ ਹੈਗਾ ਮੇਰਾ ਉਹ ਵੀ ਲੈ ਕੇ ਲੈ ਕੇ ਆਣਾ ਪਵੇਗਾ ਠੀਕ ਹੈ ਜੀ ਮੈਂ ਦੇਖੋ ਵੈਸੇ ਗੱਲ ਹੋਰ ਪੁੱਛਣੀ ਸੀਗੀ ਕਿ ਇਥੇ ਨਾ ਰਹਿਣ ਲਈ ਮਤਲਬ ਰਹਿਣ ਲਈ ਕਿੱਦਾਂ ਕੀ ਹਿਸਾਬ ਕਿਤਾਬ ਸੁਵਿਧਾ ਕੀ ਹੈਗੀ ਉੱਥੇ ਰਹਿਣ ਦੀ ਥੋੜੇ ਦਿਨ ਰੁਕਣਾ ਵੀ ਪੈ ਸਕਦਾ ਨਾ ਸਾਨੂੰ ਉੱਥੇ ਰੁਕਣ ਵੀ ਕੀ ਹੈ ਮਤਲਬ ਹੈਗੇ ਅੱਛਾ ਜੀ ਕਰਤਾਰਪੁਰ ਚ ਹੋਰ ਕਿਹੜੀਆਂ ਕਿਹੜੀਆਂ ਮੁੱਖ ਜਗਹਾ ਵੇਖਣ ਵਾਲੀ ਆ ਹੈਗੀਆਂ ਵਾਂ ਇਹ ਬਹੁਤ ਰੋਮਾਂਚਕ ਲੱਗਦਾ ਪਿਆ ਮੈਨੂੰ ਤਾਂ ਕੀ ਮੈਨੂੰ ਹੋਰ ਕੋਈ ਹੋਰ ਵਿਸ਼ੇਸ਼ ਨਿਯਮ ਦੀ ਪਾਲਣਾ ਕਰੇ ਕਰਨੀ ਪਵੇਗੀ ਕਿ ਇਨੇ ਨਿਯਮ ਹੈਗੇ ਆ ਜਾਂ ਮੈਨੂੰ ਕੋਈ ਹੋਰ ਚੀਜ਼ ਬਾਰੇ ਕੁਛ ਤੁਸੀਂ ਦੱਸੋਗੇ ਕੁਛ ਮੈਨੂੰ ਲੋੜ ਹੈਗੀ ਹੋਰ ਜਾਨਣ ਦੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਡਾ ਤੁਸੀਂ ਮੇਰੀ ਬਹੁਤ ਮਦਦ ਕੀਤੀ ਹੈ ਜੀ ਜੀ ਬਿਲਕੁਲ ਜੀ ਬਿਲਕੁਲ ਧੰਨਵਾਦ ਸਤਿ ਸ਼੍ਰੀ ਅਕਾਲ ਜੀ